ਹੈਲੋ ਸਤਿ ਸ਼੍ਰੀ ਅਕਾਲ ਸਰ ਮੈਂ ਗੁਰਦਾਸਪੁਰ ਜ਼ਿਲ੍ਹੇ ਤੋਂ ਬੋਲ ਰਹੀ ਹਾਂ ਹਾਂਜੀ ਮੈਂ ਪੀਜ਼ਾ ਡਿਲੀਵਰੀ ਦਾ ਪੀਜ਼ਾ ਦਾ ਔਡਰ ਕੀਤਾ ਸੀਗਾ ਬਟ ਤੁਹਾਡਾ ਜਿਹੜਾ ਡਿਲੀਵਰੀ ਬੁਆਏ ਆਇਆ ਵੀ ਪੀਜ਼ਾ ਦੇਣ ਉਹ ਉਹਦਾ ਰਵੱਈਆ ਠੀਕ ਨਹੀਂ ਸੀਗਾ ਹਾਂਜੀ ਬਿਲਕੁਲ ਉਹਦਾ ਬੋਲਣ ਦਾ ਤਰੀਕਾ ਉਹਦਾ ਵੇਖਣ ਦਾ ਤਰੀਕਾ ਨਜ਼ਰੀਆ ਉਹਦੀ ਬੋਡੀ ਲੈਂਗੁਏਜ ਕੁਛ ਵੀ ਸਹੀ ਨਹੀਂ ਸੀਗਾ ਹਾਂਜੀ ਹਾਂ ਉਹ ਜਿਵੇਂ ਕਿ ਪੀਜ਼ਾ ਦੇਣ ਨਾਲੋਂ ਜ਼ਿਆਦਾ ਦੂਸਰੇ ਦੇ ਪਰਸਨਲ ਚੀਜ਼ਾਂ ਪੁੱਛ ਰਿਹਾ ਸੀਗਾ ਔਰ ਉਹਦਾ ਵੇਖਣ ਦਾ ਨਜ਼ਰੀਆ ਉਹਦਾ ਆਈ ਕਿਊ ਲੈਵ ਜਿਹੜਾ ਵੇਖਣ ਦਾ ਨਜ਼ਰੀਆ ਸੀਗਾ ਉਹ ਠੀਕ ਨਹੀਂ ਸੀਗਾ ਕਿਸੇ ਧੀਆਂ ਭੈਣਾਂ ਵਾਲੇ ਘਰਾਂ ਵਿੱਚ ਐਵੇਂ ਦੇ ਤੁਸੀਂ ਕਸ ਭੇਜੋਗੇ ਡਿਲੀਵਰੀ ਬੁਆਏ ਤਾਂ ਕੋਈ ਵੀ ਉਹਨਾਂ ਨੂੰ ਅਲੋਅ ਨਹੀਂ ਕਰੇਗਾ ਤੁਹਾਡਾ ਤੁਹਾਡੀ ਕੰਪਨੀ ਦੇ ਵਾਸਤੇ ਚੀਜ਼ਾਂ ਸਹੀ ਨਹੀਂ ਨੇ ਹਾਂਜੀ ਔਰ ਉਹਦਾ ਬਿਹੇਵੀਅਰ ਵੀ ਬਹੁਤ ਖਰਾਬ ਸੀਗਾ ਜਦੋਂ ਅਸੀਂ ਉਹਨਾਂ ਨੂੰ ਇਸ ਚੀਜ਼ਾਂ ਵਾਸਤੇ ਬੋਲਿਆ ਤਾਂ ਉਹਦਾ ਅੱਗੋਂ ਜਿਹੜਾ ਰਵੱਈਆ ਸੀਗਾ ਬਿਲਕੁਲ ਵੀ ਬਰਦਾਸ਼ਤ ਕਰਨ ਦੇ ਲਾਇਕ ਨਹੀਂ ਸੀਗਾ ਇਸ ਲਈ ਮੈਂ ਤੁਹਾਨੂੰ ਇਸ ਕੰਪਲੇਂਟ ਕਰ ਰਹੀ ਹਾਂ ਕਿਰਪਾ ਕਰਕੇ ਇਹਦੇ ਉਹਦੇ ਖਿਲਾਫ ਜੋ ਵੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇ ਅਤੇ ਧੰਨਵਾਦ